ਖੇਡਾਂ ਪੇਂਡੂ ਲੋਕਾਂ ਨੂੰ ਜੀਵਨ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਨੇ ਜਿਵੇਂ ਕਿ ਖੇਡਾਂ ਦੇ ਖੇਡਣ ਨਾਲ ਕੋਈ ਆਪਣਾ ਪੇਂਡੂ ਲੋਕ ਹੁੰਦੇ ਨੇ ਆਪਣਾ ਕੰਮ ਕਾਰ ਤੋਂ ਵਿਹਲੇ ਹੋ ਕੇ ਅਤੇ ਉਹ ਆਪਣੇ ਜਿਵੇਂ ਜਵਾਕਾਂ ਨੂੰ ਲੈ ਕੇ ਖੁੱਲ੍ਹੇ ਮੈਦਾਨ ਵਿੱਚ ਉਹ ਆਪਣਾ ਜਿਹੜਾ ਵਿਹਲਾ ਸਮਾਂ ਹੈ ਉਹ ਐਵੇਂ ਬਤੀਤ ਕਰਦੇ ਨੇ ਉਹ ਇਹਦੇ ਨਾਲ ਇਹ ਹੁੰਦਾ ਕਿ ਇੱਕ ਤਾਂ ਉਹ ਜਿਹੜਾ ਉਨ੍ਹਾਂ ਦਾ ਸਮਾਂ ਥੋੜ੍ਹਾ ਬਹੁਤ ਬਚਿਆ ਹੁੰਦਾ ਹੈ ਅਤੇ ਉਹਦੇ ਨਾਲ ਉਹ ਆਪਣੀਆਂ ਖੇਡਾਂ ਜਦੋਂ ਖੇਡਦੇ ਨੇ ਉਹਨਾਂ ਦੇ ਸਰੀਰ 'ਚ ਉਹਨਾਂ ਦੀ ਤੰਦਰੁਸਤੀ ਬਣੀ ਹੁੰਦੀ ਹੈ ਲਚਕੀਲਾਪਣ ਬਣਿਆ ਰਹਿੰਦਾ ਏ ਅਤੇ ਉਨ੍ਹਾਂ ਦੇ ਖੇਡਾਂ ਦੇ ਨਾਲ ਪਸੀਨਾ ਨਿਕਲਦਾ ਜੋ ਕਿ ਆਪਣੇ ਆਪ ਮਤਲਬ ਇੱਕ ਮਨੁੱਖੀ ਸਰੀਰ ਲਈ ਬਹੁਤ ਵਧੀਆ ਚੀਜ਼ ਹੈ ਅਤੇ ਆਪਣਾ ਜਿਹੜਾ ਮਨੁੱਖੀ ਸਰੀਰ ਹੈ ਬਿਮਾਰੀਆਂ ਤੋਂ ਦੂਰ ਰਹਿੰਦਾ ਅਤੇ ਇਸ ਇਸ ਤਰ੍ਹਾਂ ਜਿਹੜੀਆਂ ਖੇਡਾਂ ਨੇ ਉਹ ਇੱਕ ਮਨੁੱਖੀ ਜੀ ਆਪਣਾ ਪੇਂਡੂ ਅਤੇ ਲੋ ਜੀਵਨ ਦੇ ਲੋਕਾਂ ਲਈ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਨੇ